ਸਤਿ ਸ਼੍ਰੀ ਅਕਾਲ ਵੀਰੇ ਵੈਰੀ ਵੈਰੀ ਗੁੱਡ ਮੋਰਨਿੰਗ ਹਾਂਜੀ ਵੀਰੇ ਕੌਣ ਹਾਂਜੀ ਹਾਂਜੀ ਮਨਜੀਤ ਸਟੂਡੀਓ ਸੇ ਬਾਤ ਕਰ ਰਹੇ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ ਹਾਂਜੀ ਹਾਂਜੀ ਖਾਈ ਫੇਮੇਗੀ ਇਹ ਕਿੱਥੇ ਰਹਿ ਗਿਆ ਮਨਦੌਤ ਦੇ ਕੋਲ ਹੀ ਏ ਹਾਂਜੀ ਹਾਂਜੀ ਹਾਂਜੀ ਹਾਂਜੀ

ਅੰਗੇਜ਼ਮੈਂਟ ਬਾਰੇ ਅੰਗੇਜ਼ਮੈਂਟ ਦੇ ਫੋਟੋ ਸ਼ੂਟ ਕਰਵਾਉਣੀ ਹੈ ਜਾਂ ਮੈਰਿਜ਼ ਦੇ ਫੋਟੋ ਸ਼ੂਟ ਕਰਵਾਉਣੀ ਜਾਂ ਪ੍ਰੀ ਵੈਡਿੰਗ ਕਰਵਾਉਣੀ ਹੈ ਜੀ ਜੀ ਠੀਕ ਹੈ ਜੀ ਠੀਕ ਹੈ ਜੀ ਜੀ ਜੀ ਜੀ ਬਸ ਮਾਲਕ ਦੀ ਕਿਰਪਾ ਨਹੀਂ ਹੈ ਪਰ ਆਪਾਂ ਹੁਣ ਤੁਸੀਂ ਪਹਿਲਾਂ ਪ੍ਰੀ ਵੈਡਿੰਗ ਕਰਵਾਉਣੀ ਹੈ ਜਾਂ ਅੰਗੇਜ਼ਮੈਂਟ ਦੀ ਫੋਟੋ ਸ਼ੂਟ ਕਰਵਾਉਣੀ ਹੈ

ਵੀਰੇ ਇਕੱਲੀ ਫੋਟੋ ਹੀ ਕਰਵਾਉਣੀ ਕਿ ਨਾਲ ਵੀਡੀਓਗ੍ਰਾਫੀ ਵੀ ਕਰਵਾਉਣੀ ਹੈ ਓਨਲਾਈਨ ਵੀ ਕਰਵਾਉਣੀ ਕਿ ਸਿਰਫ ਓਫਲਾਈਨ ਹੀ ਅੱਛਾ ਓਫਲਾਈਨ ਹੀ ਕਰਵਾਉਣੀ ਓਨਲਾਈਨ ਨਹੀਂ ਕਰਵਾਉਣੀ ਠੀਕ ਹੈ ਜੀ ਵੀਰੇ ਦੇਖੋ ਇਹ ਨਾ ਅਲੱਗ ਅਲੱਗ ਸਿਸਟਮ ਦਾ ਅਲੱਗ ਅਲੱਗ ਚੱਲਦਾ ਜਿੱਦਾਂ ਦੀ ਪਿਕਚਰ ਕੁਆਲਿਟੀ ਚਾਹੁੰਦੇ ਹੋ ਜਾਂ ਜਿੱਦਾਂ ਦੀ ਤੁਸੀਂ ਕੁਆਲਿਟੀ ਤਾਂ ਮਤਲਬ ਜਿੱਦਾਂ ਤੁਸੀਂ ਕੁਆਲਿਟੀ ਚਾਹੁੰਦੇ ਹੋ ਕੁਆਲਿਟੀ 'ਤੇ ਡਿਪੈਂਡ ਕਰਦਾ ਜਿਹੋ ਜਿਹੀ ਕੁਆਲਿਟੀ ਉਹੋ ਜਿਹਾ ਪ੍ਰਾਈਜ਼ ਨਹੀਂ ਅੰਗੇਜ਼ਮੈਂਟ ਆਪਣੇ ਇੱਥੇ ਤੁਹਾਡਾ ਖਾਈਵੇਅ 'ਚ ਹੀ ਹੈ ਜਾਂ ਆਸੇ ਪਾਸੇ ਜਾਣਾ ਠੀਕ ਹੈ ਜੀ ਲੋਕਲ ਹੀ ਹੈ ਫਿਰ ਤਾਂ ਕੋਈ ਗੱਲ ਨਹੀਂ ਹੋ ਜੇਗਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਜਦੋਂ ਕਹੋਗੇ ਉਦੋਂ ਆ ਜਾਂਗੇ ਅੱਛਾ ਪੰਦਰ੍ਹਾਂ ਤਰੀਕ ਦੀ ਹੈ ਜੀ ਠੀਕ ਇਹ ਇੱਕ ਹੁੰਦੀ ਵੀ ਫੋਰ ਕੇ ਹੁੰਦੀ ਇੱਕ ਅਲਟਰਾ ਫੋਰ ਕੇ ਹੁੰਦੀ ਹੈ ਇੱਕ ਅਲਟਰਾ ਵਾਈਡ ਹੁੰਦੀ ਹੈ ਜਿਹੋ ਜੀ ਤੁਸੀਂ ਚਾਹੁੰਦੇ ਆਪਾਂ ਉਹੋ ਜਿਹੀ ਵੀਡੀਓ ਵਾਪਿਸ ਕਰ ਦਾਂਗੇ ਚਲੋ ਕੋਈ ਗੱਲ ਨਹੀਂ ਜੀ ਦੇਖੋ ਤੁਹਾਨੂੰ ਹਰੇਕ ਚੀਜ਼ ਦੀ ਕੁਆਲਿਟੀ ਮਿਲੇਗੀ ਪਿਕਚਰ ਕੁਆਲਿਟੀ ਮਿਲੇਗੀ ਵੀਡੀਓ ਗ ਵੀਡੀਓ ਦੀ ਕੁਆਲਿਟੀ ਵੀ ਮਿਲੇਗੀ ਅਤੇ ਕੋਈ ਗੱਲ ਨਹੀਂ ਪ੍ਰਾਈਜ਼ ਤਾਂ ਵੀਰੇ ਹਾਂਜੀ ਹਾਂਜੀ ਹਾਂਜੀ ਬੋਲੋ ਵੀਰੇ ਪ੍ਰਾਏ ਪ੍ਰੀ ਵੈਡਿੰਗ ਵਾਸਤੇ ਤਾਂ ਅਲੱਗ ਅਲੱਗ ਸ਼ੋਟਸ ਸਟੂਡੀਓ ਬਣੇ ਹੋਏ ਜਿੱਥੇ ਕਹੋਗੇ ਆਪਾਂ ਉੱਥੇ ਕਰਵਾ ਲਵਾਂਗੇ ਓਟ ਓਫ ਸਟੇਸ਼ਨ ਜਾਣਾ ਤਾਂ ਉੱਥੇ ਚਲਦੇ ਰਹਾਂਗੇ ਕੋਈ ਚੱਕਰ ਨਹੀਂ ਅਤੇ ਜੇ ਲੋਕਲ ਹੀ ਕਰਵਾਉਣੀ ਤਾਂ ਲੋਕਲ ਵੀ ਕਰਵਾ ਸਕਦੇ ਹੋ ਲੋਕਲ ਵੀ ਬਹੁਤ ਆਉਂਦੇ ਕਿਸੇ ਨੇ ਜਿੱਥੇ ਪ੍ਰੀ ਵੈਡਿੰਗ ਕਰਵਾਉਣੀ ਹੈ ਬਾਕੀ ਜੇ ਤਾਂ ਇੱਕ ਵਾਰੀ ਅੰਗੇਜ਼ਮੈਂਟ 'ਤੇ ਫੋਕਸ ਕਰੋ ਪਹਿਲਾਂ ਅੰਗੇਜਮੈਂਟ ਹੋ ਲਵੋ ਅੰਗੇਜ਼ਮੈਂਟ ਤੋਂ ਬਾਅਦ ਪ੍ਰੀ ਵੈਡਿੰਗ ਹੋ ਜੇਗੀ ਕੋਈ ਚੱਕਰ ਨਹੀਂ ਗਾ

ਅਤੇ ਅਲੱਗ ਅਲੱਗ ਤੁਸੀਂ ਵੀ ਜਿਵੇਂ ਤਰੀਕ ਬੁੱਕ ਕਰਵਾ ਦਿੰਦੇ ਤਾਂ ਥੋੜ੍ਹਾ ਜ਼ਿਆਦਾ ਵਧੀਆ ਸੀਗਾ ਠੀਕ ਹੈ ਜੀ ਠੀਕ ਹੈ ਜੀ ਵੀਰੇ ਆਪਣਾ ਨਾ ਵੇਖੋ ਐਂ ਹੁੰਦਾ ਦੇਖੋ ਅੱਲਾ ਦੇਖਦਾ ਨਾ ਆਪਦਾ ਉਹ ਸਿਸਟਮ ਹੁੰਦਾ ਤੁਹਾਡੇ ਅੰਗੇਜ਼ਮੈਂਟ ਦੀ ਕੁਆਲਿਟੀ ਦਿਆਂਗੇ ਬਹੁਤ ਵਧੀਆ ਕੁਆਲਿਟੀ ਦਿਆਂਗੇ ਕਿਉਂਕਿ ਸਾਡਾ ਕੰਮ ਹੈ ਕਸਟਮਰ ਜੋੜਨਾ ਠੀਕ ਹੈ ਨਾ ਅਤੇ ਸਾਡਾ ਹੁੰਦਾ ਵੀ ਸੱਤਰ ਪਰਸੈਂਟ ਅਸੀਂ ਐਡਵਾਂਸ 'ਚ ਲੈਂਦੇ ਹਾਂ ਜੋ ਵੀ ਹੋਇਆ ਨਾ ਉਹਦਾ ਸੱਤਰ ਪਰਸੈਂਟ ਐਡਵਾਂਸ ਵਿੱਚ ਅਤੇ ਬਾਕੀ ਕੰਮ ਹੋਣ ਤੋਂ ਬਾਅਦ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਇਹ ਸਟੂਡੀਓ ਆਜੋ ਜਦੋਂ ਤੁਹਾਡਾ ਟਾਈਮ ਲੱਗੇ ਮੈਂ ਲਗਭਗ ਸਟੂਡੀਓ 'ਤੇ ਹੁੰਦਾ ਕਿਉਂਕਿ ਹੁਣ ਤਾਂ ਓਫ ਸੀਜਨ ਚੱਲਦਾ ਪਿਆ ਅਤੇ ਜਦੋਂ ਮਰਜ਼ੀ ਆਓ ਬੈਠ ਕੇ ਗੱਲ ਕਰ ਲੈਂਦੇ ਹਾਂ ਜਿੱਦਾਂ ਤੁਸੀਂ ਕਹੋਗੇ ਉੱਦਾਂ ਕਰ ਲਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ

ਠੀਕ ਹੈ ਜੀ ਕੁਝ ਇਹ ਗੱਲ ਫੇਰ ਐਂ ਕਰੋ ਕੱਲ੍ਹ ਤੁਸੀਂ ਲਗਭਗ ਬਾਰ੍ਹਾਂ ਵਜੇ ਤੋਂ ਬਾਅਦ ਆਉਣਾ ਠੀਕ ਹੈ ਨਾ ਹਾਂ ਠੀਕ ਹੈ ਵੀਰੇ ਧੰਨਵਾਦ